ਹਾਂ ਮੇਰੇ ਕੋਲ ਮਨਪਸੰਦ ਕਿਤਾਬ ਹੈ ਜੀ ਮੈਂ ਬੜੀ ਵਾਰੀ ਪੜ੍ਹੀ ਤਕਰੀਬਨ ਹਾਂ ਇਹ ਤਾਂ ਮੈਂ ਰੋਜ਼ ਹੀ ਪੜ੍ਹਦਾ ਕਈ ਵਾਰੀ ਇਸ 'ਤੇ ਵਾਪਸ ਵੀ ਆਉਂਦੇ ਰਹੀਦਾ ਇਹ ਕਿਤਾਬ ਜਿਹੜੀ ਬੜੀ ਵਧੀਆ ਹੈ ਇਤਿਹਾਸਿਕ ਕਿਤਾਬ ਹੈ ਅਤੇ ਇਹ ਕਿਤਾਬ ਬਾਬੇ ਨਾਨਕ ਦੇ ਨਾਂ 'ਤੇ ਹੈ ਅਤੇ ਇਹਦੀ ਫਿਲਮ ਵੀ ਦੇਖੀ ਵੀ ਹੈ ਦੇਖਣੀ ਵੀ ਚਾਹਵਾਂਗੇ ਮਨ ਕਰਦਾ ਰਹਿੰਦਾ ਤਕਰੀਬਨ ਇਹ ਫਿਲਮ ਹੈ ਨਾਨਕ ਨਾਮ ਜਹਾਜ ਹੈ ਚੜੇ ਸੋ ਉੱਤਰੇ ਪਾਰ ਵਾਹ ਵਾਹ ਕਿਆ ਬਾਤ ਹੈ ਵਾਹਿਗੁਰੂ